ਹੈਲੋ ਹੈਲੋ ਰਮਨ ਕੀ ਹਾਲ ਆ ਸਤਿ ਸ਼੍ਰੀ ਅਕਾਲ ਬਸ ਵਧੀਆ ਤੁਸੀਂ ਸੁਣਾਓ ਕੁਛ ਨਹੀਂ ਬੱਚਿਆਂ ਨੇ ਕੀ ਕਰਨਾ ਹੁਣ ਤਾਂ ਮੈਂ ਸੋਚ ਰਹੀ ਸੀ ਕਿ ਉਹਨਾਂ ਨੂੰ ਪਾਵਾਂ ਸਕੂਲ ਹੁਣ ਵੱਡੇ ਹੋ ਗਏ ਤੁਹਾਨੂੰ ਵੀ ਪਤਾ ਵਾ ਪੜ੍ਹਾਈ ਵੀ ਬੜੀ ਜ਼ਰੂਰੀ ਆ ਅਤੇ ਉਹੀ ਮੈਂ ਦੇਖਦੀ ਸੀਗਾ ਕਿ ਕੋਈ ਸਕੂਲ ਵਗੈਰਾ ਹਾਂ ਵੈਸੇ ਉਹ ਸਕੂਲ ਦਾ ਵੀ ਬੜਾ ਨਾਮ ਸੁਣਿਆ ਵਾ ਬਟ ਮੈਂ ਸੋਚਿਆ ਕਿ ਮੈਂ ਕਿਹਾ ਤੁਹਾਡੇ ਬੱਚੇ ਇੱਥੇ ਜਾਂਦੇ ਉੱਥੇ ਪਾ ਦਿੰਦੀ ਹਾਂ ਤੁਹਾਡੇ ਬੱਚੇ ਕਿਹੜੇ ਸਕੂਲ ਜਾਂਦੇ ਸੀ ਅੱਛਾ ਠੀਕ ਆ ਅੱਛਾ ਚਲੋ ਕੋਈ ਗੱਲ ਨਹੀਂ ਵੈਸੇ ਮੈਂ ਵੀ ਹਰਕ੍ਰਿਸ਼ਨ ਸਕੂਲ ਦਾ ਬੜਾ ਨਾਮ ਸੁਣਿਆ ਵਾ ਕੋਈ ਗੱਲ ਨਹੀਂ ਆਪਾਂ ਦੋਨੋਂ ਇਕੱਠੇ ਜਾਵਾਂਗੇ ਪਤਾ ਪੁਤਾ ਕਰਾਂਗੀਆਂ ਕਿਵੇਂ ਆ ਸਕੂਲ ਦਾ ਸਾਰਾ ਹਿਸਾਬ ਅਤੇ ਫਿਰ ਅਸੀਂ ਉੱਥੇ ਮਤਲਬ ਐਡਮਿਸ਼ਨ ਕਰਵਾ ਦਾਂਗੀਆਂ ਹਾਂਜੀ ਹੋਰ ਸੁਣਾਓ ਘਰ ਵਧੀਆ ਸਭ ਅੱਛਾ ਚਲੋ ਫਿਰ ਮਿਲਦੇ ਹਾਂ ਕੋਈ ਨਹੀਂ ਮਿਲ ਕੇ ਸਾਰਾ ਕੁਛ ਆਪਾਂ ਵੇਖਾਂਗੇ ਨਾ ਸਕੂਲ ਵਗੈਰਾ ਦੀ ਫੀਸ ਵਗੈਰਾ ਸਾਰਾ ਹਮ ਹਾਂ ਹਾਂਜੀ ਹਾਂਜੀ ਚਲੋ ਠੀਕ ਆ ਫਿਰ ਮਿਲਦੇ ਹਾਂ ਠੀਕ ਆ